ਖੂਹ ਚੋ ਪਾਣੀ ਕੱਢਣ ਲਈ ਪਹਿਲਾਂ ਇੱਕ ਰੱਸੀ ਨੂੰ ਬਾਲਟੀ ਨੂੰ ਇੱਕ ਰੱਸੀ ਨਾਲ ਬੰਨ ਕੇ ਖੂਹ ਵਿੱਚੋ ਪਾਣੀ ਕੱਢਣ ਦੀ ਪ੍ਰਕਿਰਿਆ ਸੀ ਜੋ ਬਹੁਤ ਜੋਰਦਾਰ ਪ੍ਰਕਿਰਿਆ ਸੀ ਉਸ ਤੋਂ ਬਾਅਦ ਇੱਕ ਬੈਲਟ ਨੂੰ ਤਿੰਨ ਚਾਰ ਛੋਟੀਆਂ ਛੋਟੀਆਂ ਬਾਲਟੀਆਂ ਲਾ ਕੇ ਖੂਹ ਵਿੱਚੋਂ ਪਾਣੀ ਬਲਦਾ ਨਾਲ ਗੇੜਾ ਦੇ ਕੇ ਖੂਹ ਵਿੱਚੋਂ ਪਾਣੀ ਕੱਢਿਆ ਜਾਂਦਾ ਸੀ ਫਿਰ ਇੱਕ ਰਾਟ ਨੂੰ ਫਿਰਕੀ ਨਾਲ ਅਟੈਚ ਕਰਕੇ ਹੱਥ ਦੀ ਵਰਤੋਂ ਨਾਲ ਖੂਹ ਵਿੱਚੋਂ ਪਾਣੀ ਕੱਢਿਆ ਗਿਆ ਹੁਣ ਖੂਹ ਵਿੱਚੋਂ ਪਾਣੀ ਕੱਢਣ ਲਈ ਸਮਰਸੀਬਲ ਮੋਟਰਾਂ ਅਤੇ ਟੁੱਲੂ ਮੋਟਰਾਂ ਦੀ ਵਰਤੋਂ ਹੋਣ ਲੱਗ ਪਈ